ਅਸੀਂ ਪੰਜਾਬੀ ਜਿਹੜੀ ਭਾਸ਼ਾ ਹੈ ਉਹ ਆਪਣੇ ਮਾਂ ਬਾਪ ਪੂਰੇ ਪਰਿਵਾਰ ਵਿੱਚੋਂ ਸਿੱਖੇ ਹਾਂ ਜਿਉਂ ਜਿਉਂ ਉਹ ਬੋਲਦੇ ਤੇ ਉਸ ਤਰ੍ਹਾਂ ਹੀ ਅਸੀਂ ਆਪਣੀ ਭਾਸ਼ਾ ਆਪ ਨਿਖਾਰਦੇ ਅੱਗੇ ਚਲੇ ਗਏ ਇਸ ਭਾਸ਼ਾ ਦੇ ਨਾਲ ਸਾਡਾ ਅਨੁਭਵ ਇਹ ਰਿਹਾ ਕਿ ਜੋ ਪਹਿਲਾਂ ਪੰਜਾਬੀ ਕਲਚਰ ਥਾ ਕਲਚਰ ਸੀ ਉਹ ਹੁਣ ਕਾਫੀ ਏ ਠੀਕ ਹੋ ਗਿਆ ਏ ਅਤੇ ਅਸੀਂ ਉਸ ਸੱਭਿਆਚਾਰ ਨੂੰ ਸਮਝ ਰਹੇ ਹਾਂ ਅਤੇ ਸਾਨੂੰ ਸਮਝਣ ਬੜੀ ਆਸਾਨੀ ਮਹਿਸੂਸ ਹੋ ਰਹੀ ਹੈ